ਹਾਂਜੀ ਮੈਡਮ ਮੈਂ ਤੁਹਾਡੀ ਕੰਪਨੀ ਵੱਲੋਂ ਫਲਿੱਪਕਾਰਟ ਵੱਲੋਂ ਇੱਕ ਮੋਬਾਈਲ ਫੋਨ ਦਾ ਔਡਰ ਕੀਤਾ ਸੀ ਉਸੇ ਦੇ ਸੰਬੰਧ ਵਿੱਚ ਮੈਂ ਆਪਣੇ ਵਿਚਾਰ ਦੇਣ ਲਈ ਤੁਹਾਨੂੰ ਇਹ ਕੋਲ 'ਤੇ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਪਿਛਲੇ ਦਿਨੀਂ ਅ ਕੁਝ ਦਿਨ ਪਹਿਲਾਂ ਇੱਕ ਮੋਬਾਇਲ ਫੋਨ ਸੈਮਸੰਗ ਦਾ ਆਡਰ ਕੀਤਾ ਸੀਗਾ ਕਿਉਂਕਿ ਉੱਥੇ ਇੱਕ ਜੋ ਤੁਹਾਡੀ ਅ ਨਵੇਂ ਸਾਲ ਦੇ ਉੱਪਰ ਸੇਲ ਲੱਗੀ ਹੁੰਦੀ ਆ ਉਹ ਸੇਲ ਦੇ ਵਿੱਚ ਮੈਨੂੰ ਕਾਫੀ ਚੰਗਾ ਔਫਰ ਮਿਲ ਰਿਹਾ ਸੀ ਅਤੇ ਮੇਰਾ ਪੁਰਾਣਾ ਫੋਨ ਵੀ ਉਹਨਾਂ ਨੇ ਉਸ ਐਕਸਚੇਂਜ ਆਫਰ ਦੇ ਵਿੱਚ ਉਹਨਾਂ ਨੇ ਕੱਟ ਲਿਆ ਸੀ ਅਤੇ ਮੈਂਨੂੰ ਜੋ ਪ੍ਰੋਡਕਟ ਆ ਸਮੇਂ ਸਿਰ ਸਗੋਂ ਸਮੇਂ ਜੋ ਔਨਲਾਈਨ ਦਿਖਾ ਰਿਹਾ ਸੀ ਟਾਈਮ ਉਸ ਤੋਂ ਵੀ ਦੋ ਦਿਨ ਪਹਿਲਾਂ ਹੀ ਮੈਨੂੰ ਉਹ ਆਡਰ ਡਿਲੀਵਰ ਹੋ ਗਿਆ ਅਤੇ ਮੋਬਾਇਲ ਫੋਨ ਬਿਲਕੁਲ ਠੀਕ ਹਾਲਤ ਦੇ ਵਿੱਚ ਸੀ ਪੈਕਿੰਗ ਉਹਦੀ ਬਹੁਤ ਵਧੀਆ ਸੀ ਅਤੇ ਮੋਬਾਇਲ ਫੋਨ ਦੀ ਅ ਪੈਕਿੰਗ ਚੰਗੀ ਹੋਣ ਕਰਕੇ ਉਸੇ ਕਿਸੇ ਵੀ ਤਰ੍ਹਾਂ ਦਾ ਕੋਈ ਝਰੀਟ ਵਗੈਰਾ ਨਹੀਂ ਸੀ ਤਾਂ ਮੈਂ ਇਸ ਸਬੰਧੀ ਆਪਣੀ ਤਸੱਲੀ ਪ੍ਰਗਟ ਕਰਦਾ ਹਾਂ ਅਤੇ ਇਹ ਵੀ ਇਸ ਸਬੰਧੀ ਮੈਂ ਇਹ ਵੀ ਫੀਡਬੈਕ ਦੇਣਾ ਚਾਹੁੰਦਾ ਹੈ ਕਿ ਮੋਬਾਇਲ ਫੋਨ ਬਹੁਤ ਚੰਗੀ ਅ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਉਹਦੇ ਵਿੱਚ ਕੋਈ ਵੀ ਨੁਕਸ ਨਹੀਂ ਹੈ ਉਹਦੀ ਜੋ ਮੋਬਾਇਲ ਫੋਨ ਦੀ ਨੈਟਵਰਕ ਕਵਰੇਜ ਹੈ ਉਹ ਬਹੁਤ ਹੀ ਵਧੀਆ ਹੈ ਸਾਊਂਡ ਕੁਆਲਿਟੀ ਵੀ ਵਧੀਆ ਹੈ ਅਤੇ ਕੈਮਰੇ ਦੀ ਜੋ ਫੋਟੋ ਦੀ ਕੁਆਲਿਟੀ ਹੈ ਫੋਟੋ ਦੀ ਗੁਣਵੱਤਾ ਹੈ ਉਹ ਵੀ ਬਹੁਤ ਚੰਗੇ ਪੱਧਰ ਦੀ ਹੈ ਅਤੇ ਮੈਂ ਇਸ ਸਬੰਧੀ ਆਪ ਜੀ ਦਾ ਧੰਨਵਾਦ ਕਰਦਾ ਹਾਂ ਜੀ ਕਿ ਆਡਰ ਸਮੇਂ ਸਿਰ ਤੁਸੀਂ ਪਹੁੰਚਾਇਆ ਅਤੇ ਮੋਬਾਇਲ ਫੋਨ ਇੱਕ ਚੰਗੀ ਚੰਗੀ ਗੁਣਵਤਾ ਵਾਲਾ ਮੋਬਾਇਲ ਫੋਨ ਤੁਸੀਂ ਮੈਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ